ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਿਹੜੀ ਫੈਕਟਰੀ ਅੱਛਾ ਇੱਕ ਤਾਂ ਸਾਡੇ ਸਾਹਮਣੇ ਹੀ ਆ ਆਈਸ ਫੈਕ ਫੈਕਟਰੀ ਆ ਠੀਕ ਹੈ ਹਾਂਜੀ ਇਹ ਹਾਂਜੀ ਹਾਂਜੀ ਹਾਂ ਹਾਂ ਹਾਂ ਨਾਲੇ ਪਤਾ ਕੀ ਮੇਰੇ ਕੋਲੇ ਥੋੜ੍ਹਾ ਜਿਹਾ ਇਹ ਆ ਨਾ ਕੰਮ ਕੁੰਮ ਕਰਕੇ ਆਉਂਦੀ ਜਾਂਦੀ ਰਹਿੰਦੀ ਦੁਨੀਆਂ 'ਤੇ ਤਾਂ ਕਰਕੇ ਅਤੇ ਉਹ ਫਿਰ ਪਤਾ ਲੱਗ ਜਾਂਦਾ ਹਾਂ ਮੇ ਮੇਰੀ ਨਾਲੇਜ ਥੋੜ੍ਹੀ ਤਾਂ ਵੱਧ ਗਈ ਨਹੀਂ ਤਾਂ ਮੈਂ ਇੰਨੀ ਜੋਗੀ ਨਹੀਂ ਸੀ ਹਾਂਜੀ ਤੁਸੀਂ ਕੀ ਪੁੱਛਣਾ ਜੀ ਠੀਕ ਆ ਹਾਂ ਹਾਂ ਹਾਂ ਦੇਖੋ ਵੈਸੇ ਤਾਂ ਪਰਿੰਡ ਪਿੰਡ ਦੀ ਤਾਂ ਕੋਈ ਆਪਾਂ ਰੀਸ ਕਰ ਹੀ ਨਹੀਂ ਸਕਦੇ ਹੈ ਨਾ ਹਾਂ ਪਰ ਹੁਣ ਆਪਣਾ ਰੋਜ਼ ਡੇਲੀ ਵਾਂਗੂੰ ਆਪਣੀ ਸਬਜ਼ੀ ਇੱਦਾਂ ਆ ਵੀ ਨਹੀਂ ਸਕਦੀ ਹੈ ਨਾ ਪਰ ਇਹ ਆ ਕੀ ਚਲੋ ਖਾਦ ਸਪਰੇਅ ਬਿਨਾਂ ਤੋਂ ਬਿਨਾਂ ਹੁੰਦੀ ਆ ਜਾਨੀ ਕਿ ਸਪਰੇਅ ਸਪਰੁਅ ਪਾਈ ਹੁੰਦੀ ਆ ਉਹ ਤੋਂ ਬਿਨਾਂ ਹੁੰਦੀ ਵਧੀਆ ਪਿੰਡ ਦੀ ਸਬਜ਼ੀ ਪਰ ਅੱਜ ਕੱਲ੍ਹ ਤਾਂ ਵੈਸੇ ਪਿੰਡਾਂ ਤੋਂ ਹੀ ਲੋਕੀ ਆਉਣ ਲੱਗ ਪਏ ਇੱਥੇ ਲੈ ਕੇ ਆਪਣੀਆਂ ਤਾਜ਼ੀਆਂ ਸਬਜ਼ੀਆਂ ਉਹਦੇ ਕਰਕੇ ਮੈਂ ਤੁਹਾਨੂੰ ਇਹ ਕਹੂੰਗੀ ਕਿ ਵੈਸੇ ਚਲੋ ਠੀਕ ਐ ਵੀ ਅੱਜ ਕੱਲ੍ਹ ਇੰਨਫੈਕਸ਼ਨ ਵੀ ਬਹੁਤ ਵੱਧ ਰਹੀ ਆ ਸਹੀ ਖਾਣੀ ਚਾਹੀਦੀ ਆ ਅਤੇ ਪਰ ਮੈਂ ਤੁਹਾਨੂੰ ਐਡਰਸ ਇਹ ਦੇਊਂਗੀ ਇੱਕ ਨਾ ਇੱਥੇ ਸਾਡੇ ਗੁਰਦੁਆਰਾ ਜਾਂ ਤੁਸੀਂ ਹਜੇ ਤੱਕ ਪਤਾ ਨਹੀਂ ਬਾਬਾ ਫਰੀਦ ਗਏ ਹੋ ਕਿ ਨਹੀਂ ਹਾਂ ਅੱਛਾ ਅਤੇ ਉਹਨੇ ਇੱਧਰੋਂ ਆਪਾਂ ਜਦੋਂ ਲੰਘਦੇ ਆ ਨਾ ਠੰਡੀ ਸੜਕ 'ਤੇ ਉੱਥੇ ਇੱਕ ਆਪਣੇ ਗੁਰਦੁਆਰਾ ਆਪਣੇ ਰਾਜੇ ਦਾ ਹੀ ਆ ਫਰੀਦਕੋਟ ਦੇ ਰਾਜੇ ਦਾ ਅਤੇ ਜੀਨੇ ਕਰਕੇ ਉਹਦੇ ਸਾਹਮਣੇ ਜਾਨੀ ਕਿ ਮ ਕੁਝ ਬਣਿਆ ਵੀ ਉੱਥੇ ਤਾਜ਼ਾ ਮਿਲਦਾ ਲੇਡੀਜ ਨੇ ਜਾਨੀ ਕਿ ਆਪਣੀ ਆਪਣੀਆਂ ਦੁਕਾਨਾਂ ਲਾਈਆਂ ਹੋਈਆਂ ਆਪਣੀ ਘਰੋਂ ਤਾਜ਼ਾ ਸਬਜ਼ੀਆਂ ਬਣਾ ਕੇ ਲਿਆਉਂਦੀਆਂ ਜਿਵੇਂ ਤੋਰੀ ਤੁਰੀ ਦੀਆਂ ਅਤੇ ਜਿਹੜੀ ਉਹਨਾਂ ਦੇ ਸਾਹਮਣੇ ਨਾ ਦੋ ਰੇੜੀਆਂ ਲੱਗਦੀਆਂ ਡੇਲੀ ਰੁਟੀਨ ਨਾਲ ਲੱਗਦੀਆਂ ਅਤੇ ਉਹਦੇ ਵਿੱਚ ਤਾਜ਼ੀਆਂ ਮੂਲੀਆਂ ਪਾਲਕ ਮੇਥੀ ਸਾਗ ਭਿੰਡੀਆਂ ਮਤਲਬ ਕੱਦੂ ਹੋਇਆ ਇੱਦਾਂ ਤੋਰੀਆਂ ਉਹਨਾਂ ਨੇ ਘਰ ਦੀਆਂ ਬਣ ਹੁੰਦੀਆਂ ਇਹ ਲੱਗੀਆਂ ਵੀਆਂ ਹਾਂ ਮੈਨੂੰ ਯਾਨੀ ਕਿ ਹਾਂ ਮੈਨੂੰ ਮੈਨੂੰ ਜਾਨੀ ਕਿ ਉਥੋਂ ਹੀ ਹਾਂ ਠੀਕ ਆ ਦਸ ਵੀਹ ਰੁਪਏ ਮਹਿੰਗੀ ਜ਼ਰੂਰ ਹੁੰਦੀ ਮਾਰਕੀਟ ਨਾਲੋਂ ਹਾਂ ਹਾਂ ਹਾਂ ਹਾਂ ਉਹਦੇ ਕਰਕੇ ਬਸ ਮੈਨੂੰ ਉਹ ਉਥੋਂ ਹੀ ਲੈਣਾ ਪਸੰਦ ਆ ਸਬਜ਼ੀਆਂ ਸੁਬਜ਼ੀਆਂ ਜੋ ਵੀ ਆ ਅਤੇ ਜਿਹੜਾ ਬਾਕੀ ਸਮਾਨ ਆ ਉਹ ਰਾਮਾ ਬੇਕਰੀ ਦੇ ਕੋਲੋਂ ਹੀ ਆ ਹਾਂ ਜੇ ਆਪਾਂ ਦੂਸਰਾ ਸੁੱਕਾ ਸਮਾਨ ਵੀ ਖਾਂਦੇ ਹਾਂ ਅਤੇ ਉਹ ਰਾਮਾ ਬੇਕਰੀ ਆ ਅਤੇ ਜਿਹੜੀ ਇਹੀ ਹੈ ਅਤੇ ਇਹ ਆਪਾਂ ਨੂੰ ਇੱਥੇ ਬਾਬਾ ਫਰੀਦ ਸਰਕਾਰੀ ਗੁਰਦੁਆਰਾ ਜਿਹੜਾ ਰਾਜੇ ਦਾ ਉਹਦੇ ਸਾਹਮਣੇ ਯਾਨੀ ਕਿ ਰੇੜੀਆਂ ਲੱਗਦੀਆਂ ਹਾਂ ਹਾਂ ਹਾਂ ਤਾਜ਼ਾ ਮੈਂ ਤੁਹਾਨੂੰ ਇਹੀ ਹਾਂ ਹਾਂ ਮਤਲਬ ਸਾਰਾ ਹੀ ਆ ਅੱਜ ਦੇ ਮਾਹੌਲ ਜਿਵੇਂ ਮੌਸਮ ਦੇ ਹਿਸਾਬ ਨਾਲ ਹੈ ਨਾ ਹਾਂ ਹਾਂ ਸਾਰਾ ਕੁਝ ਤਾਜ਼ਾ ਹੀ ਹੁੰਦਾ ਦੀਦੀ ਉਹਦਾ ਨਾ ਜਾਨੀ ਕਿ ਘਰ ਦੀ ਆ ਹਾਂ ਅਤੇ ਇਹ ਜਾਨੀ ਕਿ ਉਹਨਾਂ ਦੀਆਂ ਨਾ ਮੁਸਕੀਆਂ 'ਤੇ ਚਾਰ ਰੋਡ ਬਾਗ ਬਣਿਆ ਵਾ ਫਰੂਟ ਵਗੈਰਾ ਵੀ ਉਹਨਾਂ ਤੋਂ ਸਾਈਡ 'ਤੇ ਉਹਨਾਂ ਦੇ ਡੈ ਡੈਡੀ ਆ ਜਿਹੜੇ ਉਹਨਾਂ ਨੇ ਫਰੂਟ ਵਗੈਰਾ ਲਾਇਆ ਹੁੰਦਾ ਕਿੰਨੂ ਵਗੈਰਾ ਸੇਬ ਸੁਬ ਹਾਂ ਹਾਂ ਨਹੀਂ ਮੈਂ ਤਾਂ ਵੈਸੇ ਨਾ ਮੈਂ ਪਤਾ ਕੀ ਕਰਦੀ ਹਾਂ ਮੈਂ ਰੋਜ਼ ਡੇਲੀ ਨੂੰ ਰੂਟੀਨ ਨਾਲ ਜਾਨੀ ਕਿ ਜਿੰਨਾ ਕੁ ਲੱਗਦਾ ਘਰੇ ਖਾਣ ਨੂੰ ਉਨਾ ਕੁ ਉਥੋਂ ਤਾਜ਼ਾ ਲਿਆਵਨੀ ਹਾਂ ਅਤੇ ਫਿਰ ਘਰੇ ਆ ਕੇ ਵੀ ਆਪਾਂ ਫਰਿੱਜਾਂ 'ਚ ਰੱਖਣਾ ਫਰਿੱਜ ਵਾਲਾ ਕੰਮ ਵੀ ਗਲਤ ਹੋ ਜਾਂਦਾ ਹਾਂ ਮੈਂ ਤਾਂ ਹੁਣ ਮੁਹੱਲੇ 'ਚ ਆਪਾਂ ਬੈਠੇ ਹਾਂ ਹੈ ਨਾ ਵੀ ਤਾਜ਼ੀ ਜਾਨੀ ਕਿ ਸਬਜ਼ੀ ਖਾਈਦੀ ਆ ਫਿਰ ਜ਼ਰੂਰ ਮੈਨੂੰ ਇਹ ਕਹਿਣਗੇ ਆਪੋ ਜੀ ਵੱਧ ਲੈ ਲਵਾਂ ਕਿ ਨਹੀਂ ਵੱਧ ਨਹੀਂ ਆਪਾਂ ਗੇੜਾ ਦੇਣਾ ਹੁੰਦਾ ਅਤੇ ਬੱਚਾ ਬੁੱਚਾ ਅਤੇ ਛੱਡਣ ਆਉਣਾ ਅਤੇ ਉੱਥੋਂ ਸਬਜ਼ੀ ਤਾਜ਼ੀ ਲੈ ਜਾਈਦੀ ਆ ਹਾਂ ਹਾਂ ਹਾਂ ਹਾਂ ਹਾਂ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਤੁਸੀਂ ਉਥੋਂ ਹੀ ਲਿਓ ਕਿ ਉਹ ਤਾਜ਼ੀ ਪੱਟ ਕੇ ਲਿਆਉਂਦਾ ਸਵੇਰੇ ਲਿਆਉਂਦਾ ਹਾਂਜੀ ਹਾਂ ਉਹ ਚਾਰ ਕੁ ਵਜੇ ਤੱਕ ਬਹਿੰਦਾ ਸ਼ਾਮ ਨੂੰ ਅਤੇ ਗਿਆਰ੍ਹਾਂ ਕੁ ਵਜੇ ਆਉਂਦਾ ਉਹ ਸਵੇਰੇ ਹਾਂ ਠੀਕ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਠੀਕ ਹਾਂਜੀ